ਮੈਂ ਜ਼ਿੰਦਗੀ ਵਿੱਚ ਕਦੇ ਵੀ ਯੋਗਾ ਦੀ ਕਲਾਸ ਨਹੀਂ ਲਗਾਈ ਪਰ ਮੈਂ ਆਮ ਤੌਰ 'ਤੇ ਟੀ ਵੀ ਉੱਤੇ ਕਈ ਤਰ੍ਹਾਂ ਦੇ ਯੋਗਾ ਟੀਚਰਾਂ ਨੂੰ ਦੇਖਦਾ ਰਹਿੰਦਾ ਹਾਂ ਇਹ ਇੱਕ ਬਹੁਤ ਹੀ ਚੰਗੀ ਚੀਜ਼ ਹੈ ਪਰ ਮੈਂ ਸਵੇਰੇ ਉੱਠਣ ਸਾਰ ਕਈ ਤਰ੍ਹਾਂ ਦੇ ਆਸਣ ਜੋ ਕਿ ਮੈਂ ਪੜ੍ਹੇ ਹਨ ਅਤੇ ਸਿੱਖੇ ਹਨ ਉਹ ਕਰਦਾ ਰਹਿੰਦਾ ਹਾਂ ਅਤੇ ਜਿਵੇਂ ਕਿ ਤਾੜ ਆਸਣ ਐਨ ਅਤੇ ਨੱਕ ਦਾ ਆਸਣ ਇਹ ਬਹੁਤ ਜ਼ਰੂਰੀ ਹਨ ਤਾੜ ਆਸਣ ਕਰਨ ਨਾਲ ਪੇਟ ਦੀ ਕਿਰਿਆ ਬਹੁਤ ਸਹੀ ਰਹਿੰਦੀ ਹੈ ਅਤੇ ਹੋਰ ਤਰ੍ਹਾਂ ਦੀ ਮੈਂ ਅਭਿਆਸ ਯੋਗਾ ਦੇ ਸਵੇਰੇ ਉੱਠਣ ਸਾਰ ਖਾਲੀ ਪੇਟ ਕਰਦਾ ਰਹਿੰਦਾ ਹਾਂ